ਹੈਲੋ ਮੈਂ ਜਗਦੀਸ਼ ਕੁਮਾਰੀ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਮੈਂ ਤੁਹਾਡੇ ਨਾਲ ਚੁਣੌਤੀਪੂਰਵ ਕੱਪੜੇ ਦੀ ਕਹਾਣੀ ਸਾਂਝੀ ਕਰਨਾ ਚਾਹੁੰਦੀ ਹਾਂ ਮੈਂ ਕਾਫੀ ਕੱਪੜੇ ਸਿਊ ਚੁੱਕੀ ਹਾਂ ਇੱਕ ਵਾਰੀ ਮੈਂ ਇੱਕ ਕਮੀਜ਼ ਸੂਟ ਲਿਆਉਂਦਾ ਸੀ ਅਤੇ ਕਮੀਜ਼ ਸੈਮੀ ਵਿੱਚ ਸੀਗਾ ਗਲਾ ਉਹਦਾ ਬਣਿਆ ਹੋਇਆ ਸੀ ਅਤੇ ਗਲੇ ਦੇ ਵਿੱਚ ਕਾਣ ਸੀ ਬਹੁਤ ਹੀ ਔਖਾ ਸੂਟ ਬਣਿਆ ਸੀ ਜਿਸ ਵਿੱਚ ਮੈਨੂੰ ਬਹੁਤ ਹੀ ਬਹੁਤ ਹੀ ਮੁਸ਼ਕਿਲ ਆਈ ਸੀ ਬਹੁਤ ਟਾਈਮ ਲੱਗਾ ਸੀ ਮੈਨੂੰ ਬਣਾਉਣ ਵਿੱਚ ਅਤੇ ਬਾਕੀ ਜਿਹੜੇ ਕੱਪੜੇ ਹਨ ਇੱਕ ਕੱਪੜਾ ਹੈ ਉਹਦਾ ਬੈਲਵੇਟ ਦਾ ਉਹ ਵੀ ਬੜਾ ਔਖਾ ਸੀਤਾ ਜਾਂਦਾ ਹੈ ਸੁਨੀਲ ਦਾ ਸੂਟ ਵੀ ਬਹੁਤ ਔਖਾ ਸੀਤਾ ਜਾਂਦਾ ਹੈ ਉਹਦੇ ਵਿੱਚ ਵੀ ਸੂਈ ਚੇਂਜ ਕਰਨੀ ਪੈਂਦੀ ਹੈ ਜਿਹੜੀ ਕਿ ਹਰ ਹਰ ਸੂਈ ਨਾਲ ਉਹ ਸੂਟ ਸੀਤਾ ਨਹੀਂ ਜਾਂਦਾ ਅਤੇ ਉਹਦੇ ਵਿੱਚ ਕਾਫੀ ਔਖਾ ਜਿਹੜਾ ਹੈ ਸੂਟ ਬਣਦਾ ਹੈ ਇਸ ਕਰਕੇ ਗਲੇ ਵਾਲਾ ਸੂਟ ਜਿਹੜਾ ਹੈ ਉਹ ਤਾਂ ਬਹੁਤ ਹੀ ਔਖਾ ਬਣਦਾ ਹੈ ਜਿਹੜਾ ਪਹਿਲੇ ਹੀ ਗਲਾ ਬਣਿਆ ਹੋਇਆ ਹੁੰਦਾ ਹੈ ਉਹਦੇ ਨਾਲ ਸਾਨੂੰ ਬੁਕਰਮ ਲਾਉਣੀ ਬਹੁਤ ਔਖੀ ਲੱਗਦੀ ਹੈ ਕਾਣ ਵਾਲਾ ਕੱਪੜਾ ਤਾਂ ਬਹੁਤ ਹੀ ਔਖਾ ਸੀਤਾ ਜਾਂਦਾ ਹੈ ਉਹ 'ਤੇ ਇੱਕ ਪਾਸੇ ਹੀ ਪਾਸੇ ਹੀ ਇੱਕ ਸਾਈਡ ਨੂੰ ਜਾਂਦਾ ਹੈ ਜਿਹੜਾ ਕਿ ਕੱਟਣ ਦੇ ਵਿੱਚ ਵੀ ਬੜਾ ਔਖਾ ਲੱਗਦਾ ਹੈ ਅਤੇ ਸਿਊਣ ਵਿੱਚ ਵੀ ਬਹੁਤ ਔਖਾ ਲੱਗਦਾ ਹੈ ਅਤੇ ਸਭ ਤੋਂ ਜ਼ਿਆਦਾ ਇਹ ਸਭ ਤੋਂ ਜ਼ਿਆਦਾ ਔਖਾ ਹਿੱਸਾ ਮੈਨੂੰ ਗਲੇ ਦਾ ਲੱਗਦਾ ਹੈ ਗਲਾ ਬਣਾਉਣ ਕਰਕੇ ਮੈਨੂੰ ਬਹੁਤ ਔਖਾ ਲੱਗਦਾ ਹੈ ਗਲਾ ਬਣਾਉਣਾ ਮੈਨੂੰ ਬਹੁਤ ਜ਼ਿਆਦਾ ਔਖਾ ਲੱਗਦਾ ਹੈ